ਸਾਡੇ ਘਰ ਵਿੱਚ ਪੀਣ ਲਈ ਬਹੁਤੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਜਿਹਨਾਂ ਵਿੱਚੋਂ ਪਹਿਲੀ ਚੀਜ਼ ਆ ਸਾਡੀ ਰੂਹ ਆਫਜਾ ਜੋ ਕਿ ਸਾਰੇ ਹੀ ਆਪਣੇ ਘਰ ਵਿੱਚ ਬਹੁਤ ਹੀ ਆਸਾਨੀ ਨਾਲ ਬਣਾ ਲੈਂਦੇ ਹਨ ਦੂਜੀ ਚੀਜ਼ ਹੈ ਨਿੰਬੂ ਪਾਣੀ ਇਹ ਪੰਜਾਬ ਦੇ ਸਾਰੇ ਭਾਰਤ ਵਿੱਚ ਲੋਕ ਬਹੁਤ ਹੀ ਪਸੰਦ ਕਰਦੇ ਹਨ ਤੀਜੀ ਚੀਜ਼ ਹੈ ਨਿੰਬੂ ਸ਼ਿਕੰਜਵੀ ਇਹ ਵੀ ਲੋਕ ਬਹੁਤ ਹੀ ਪਿਆਰ ਨਾਲ ਪੀਂਦੇ ਹਨ ਚੌਥੀ ਚੀਜ਼ ਸਾਡੇ ਘਰ ਵਿੱਚ ਬਣਾਈ ਜਾਂਦੀ ਹੈ ਦੁੱਧ ਲੱਸੀ ਪੰਜਵੀਂ ਚੀਜ਼ ਸਾਡੇ ਘਰ ਵਿੱਚ ਬਣਦਾ ਹੈ ਜਲਜੀਰਾ ਛੇਵੀ ਚੀਜ਼ ਸਾਡੇ ਘਰ ਵਿੱਚ ਬਣਦੀ ਹੈ ਜੋ ਮੱਖਣ ਦੇ ਟਾਈਮ 'ਤੇ ਲੱਸੀ ਨਿਕਲਦੀ ਹੈ ਉਹ ਵੀ ਸਾਡੇ ਘਰ ਵਿੱਚ ਬਹੁਤ ਹੀ ਮਜ਼ੇ ਨਾਲ ਲੋਕ ਸਾਰਿਆਂ ਦ ਲਈ ਸਾਰੇ ਪੀਂਦੇ ਹਨ ਔਰ ਸੱਤਵੀਂ ਚੀਜ਼ ਜੋ ਕਿ ਜੌਂ ਹੁੰਦੇ ਹਨ ਉਹਨਾਂ ਦਾ ਸੇਤੂ ਬਣਦਾ ਹੈ ਉਸ ਸੇਤੀ ਨੂੰ ਸੇਤੂ ਨੂੰ ਆਪਾਂ ਗੁੜ ਅਤੇ ਪਾਣੀ ਨਾਲ ਮਿਲਾ ਕੇ ਪੀਂਦੇ ਹਾਂ ਔਰ ਇੱਕ ਸਾਡੇ ਘਰ ਬਣਦਾ ਹੈ ਮੈਂਗੋ ਸ਼ੇਕ ਬਨਾਨਾ ਸ਼ੇਕ ਔਰ ਸਾਡੇ ਘਰ ਵਿੱਚ ਰਸਨਾ ਔਰ ਟੈਂਗ ਵੀ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ